ਸੋਸ਼ਲ ਮੀਡੀਆ ਦੇ ਕੁਝ ਖਾਤੇ ਜਿਵੇਂ ਮੌਸਮ ਬਾਰੇ ਜਾਣਕਾਰੀ ਦੇਣਾ ਹੈ ਨਾ ਉਹ ਬਹੁਤ ਵਧੀਆ ਲੱਗਦਾ ਮੈਨੂੰ ਉਹ ਮਤਲਬ ਕਿ ਜਦੋਂ ਵੀ ਕਦੇ ਕਿਤੇ ਬਾਹਰ ਜਾਣਾ ਹੋਵੇ ਤਾਂ ਮੌਸਮ ਬਾਰੇ ਪਤਾ ਕਰਨਾ ਹੋਵੇ ਤਾਂ ਉਨ੍ਹਾਂ ਦਾ ਯੂਜ ਮੈਂ ਕਰਦੀ ਕਰਦੀ ਹਾਂ ਕਿਉਂਕਿ ਉਨ੍ਹਾਂ ਤੋਂ ਹੀ ਸਾਰੀ ਜਾਣਕਾਰੀ ਮਿਲਦੀ ਹੈ ਕੁਛ ਮਤਲਬ ਕਿ ਘਰੇਲੂ ਜਾਣਕਾਰੀ ਵੀ ਮਿਲਦੀ ਹੈ ਕੁਛ ਪੌਦਿਆਂ ਬਾਰੇ ਜਾਣਕਾਰੀ ਮਿਲਦੀ ਹੈ ਕੁਛ ਅਜਿਹੇ ਖਾਤੇ ਬਣੇ ਹੋਏ ਨੇ ਪੌਦਿਆਂ ਬਾਰੇ ਜਾਣਕਾਰੀ ਮਿਲਦੀ ਹੈ ਆਪਣੇ ਆਲੇ ਦੁਆਲੇ ਬਾਰੇ ਮੈਂ ਜਾਣਕਾਰੀ ਮਿਲਦੀ ਹੈ ਬੱਚੇ ਨੇ ਅੱਗੇ ਆਪਣੇ ਦਸਵੀਂ ਤੋਂ ਬਾਅਦ ਪਲੱਸ ਟੂ ਤੋਂ ਬਾਅਦ ਕੀ ਕਰਨਾ ਇਹਦੇ ਬਾਰੇ ਵੀ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਕੁਝ ਅਜਿਹੇ ਖਾਤੇ ਹਨ ਕੁਝ ਆਪਾਂ ਨੇ ਕੋਈ ਘਰੇਲੂ ਧੰਦਾ ਸ਼ੁਰੂ ਕਰਨਾ ਉਹਦੇ ਬਾਰੇ ਪੋਲਟਰੀ ਫਾਰਮ ਖੋਲ੍ਹਣਾ ਹੈ ਖੇਤੀਬਾੜੀ ਸਬੰਧੀ ਕੁਝ ਅਜਿਹੇ ਹਨ ਖੇਤੀਬਾੜੀ ਦੀਆਂ ਫਸਲਾਂ ਰੇਹ ਸਪਰੇਅ ਖਾਦਾਂ ਬਾਰੇ ਬਹੁਤ ਸਭ ਕੁਝ ਦੱਸਿਆ ਹੋਇਆ ਜਿਨ੍ਹਾਂ ਤੋਂ ਕਿਤੇ ਬਾਹਰ ਜਾਣ ਦੀ ਲੋੜ ਹੀ ਨਹੀਂ ਘਰ ਬੈਠੇ ਆਪਣੇ ਇਨ੍ਹਾਂ ਨੂੰ ਦੇਖੋ ਜੋ ਮਰਜੀ ਜਾਣਕਾਰੀ ਲਓ ਅਗਰ ਘਰ ਵਿੱਚ ਘਰੇਲੂ ਔਰਤ ਹੈ ਉਹਨੇ ਆਪਣੀ ਸਿਲਾਈ ਕਢਾਈ ਜਾਂ ਆਪਣੀ ਰਸੋਈ ਬਾਰੇ ਕੋਈ ਜਾਣਕਾਰੀ ਲੈਣੀ ਹੈ ਇਹਦੇ ਬਾਰੇ ਵੀ ਜਾਣਕਾਰੀ ਇਨ੍ਹਾਂ ਖਾਤਿਆਂ ਵਿੱਚੋਂ ਬਹੁਤ ਸਾਰੀ ਮਿਲ ਜਾਂਦੀ ਹੈ ਜਿਵੇਂ ਵੀ ਆਪਾਂ ਲੈ ਸਕਦੇ ਹਾਂ ਆਪਾਂ ਨੂੰ ਮਤਲਬ ਕਿ ਬੰਦਾ ਜਾਣਕਾਰੀ ਲੈਣ ਵਾਲਾ ਹੋਣਾ ਚਾਹੀਦਾ ਜਾਣਕਾਰੀ ਅਕਸੈਪਟ ਕਰਨਾ ਆਉਣਾ ਚਾਹੀਦਾ ਮਤਲਬ ਕਿ ਇਹ ਨਹੀਂ ਵੀ ਇੱਕ ਵਾਰ ਪੜ੍ਹ ਇੱਕ ਵਾਰ ਉਹਨੂੰ ਪੜ੍ਹ ਲਿਆ ਉੱਥੇ ਹੀ ਛੱਡ ਦਿੱਤਾ ਨਾ ਉਹਨੂੰ ਪੜ੍ਹੋ ਚੰਗੀ ਤਰ੍ਹਾਂ ਫੋਲੋ ਕਰੋ ਜਿਹੜੇ ਕੰਮ ਦੀ ਆਪਾਂ ਨੂੰ ਜ਼ਰੂਰਤ ਹੈ ਉਸ ਤ ਉਸ ਤਰ੍ਹਾਂ ਦੀ ਉਨ੍ਹਾਂ ਦੇ ਉਨ੍ਹਾਂ ਦਾ ਖਾਤਾ ਖੋਲ੍ਹੋ ਉਵੇਂ ਦੀ ਜਾਣਕਾਰੀ ਲਓ ਉਹਨੂੰ ਫੋਲੋ ਕਰੋ ਘਰ ਆਪਾਂ ਨੇ ਮਤਲਬ ਕਿ ਹੁਣ ਜਿਵੇਂ ਫ਼ਸਲਾਂ ਨੇ ਫ਼ਸਲਾਂ ਬਾਰੇ ਕਿਹੜੀ ਖਾਦ ਕਿਹੜੀ ਸਪਰੇਅ ਕਰਨੀ ਹੈ ਕਿਹੜੀ ਫ਼ਸਲ ਕਦੋਂ ਬੀਜੀ ਜਾਣੀ ਹੈ ਇਹਦੀ ਜਾਣਕਾਰੀ ਆਪਾਂ ਜਦੋਂ ਮਰਜੀ ਲੈ ਲੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਅਪ ਮਤਲਬ ਕਿ ਇਨ੍ਹਾਂ ਖਾਤਿਆਂ ਨੂੰ ਪੜ੍ਹ ਕੇ ਬੰਦਾ ਖੁਦ ਆਪਣਾ ਮਾਸਟਰ ਆਪ ਹੈ ਇੰਨਾ ਮਤਲਬ ਕਿ ਇੰਨੇ ਜ਼ਿਆਦਾ ਭੰਡਾਰ ਪਏ ਨੇ ਇੰਨੀ ਜਾਣਕਾਰੀ ਪਈ ਹੈ ਆਪਾਂ ਕੋ ਕੋਈ ਵੀ ਕੰਮ ਕਰ ਸਕਦੇ ਹਾਂ ਇੱਥੋਂ ਤੱਕ ਕੇ ਆਪਾਂ ਨੇ ਜੇ ਕੋਈ ਆਪਣੇ ਘਰ ਕੋਈ ਮਸ਼ੀਨਰੀ ਖਰਾਬ ਹੋ ਗਈ ਤਾਂ ਇਨ੍ਹਾਂ ਖਾਤ ਬਹੁਤ ਸਾਰੇ ਖਾਤੇ ਅਜਿਹੇ ਨੇ ਜਿਨ੍ਹਾਂ ਵਿੱਚੋਂ ਓ ਉਹਦੇ ਬ ਉਹਨੂੰ ਖੋਲ ਕੇ ਜੜਨ ਤੱਕ ਦੀ ਨੋਲੇਜ ਦੀ ਸਾਰੀ ਨੋਲੇਜ ਜਾਣਕਾਰੀ ਦਿੱਤੀ ਹੋਈ ਹੈ ਆਪਾਂ ਉਹ ਲੈ ਸਕਦੇ ਹਾਂ ਮੈਨੂੰ ਇਨ੍ਹਾਂ ਤੋਂ ਬਹੁਤ ਜ਼ਿਆਦਾ ਫ਼ਾਇਦਾ ਹੋਇਆ ਮੈਂ ਤਾਂ ਜ਼ਿਆਦਾਤਰ ਇਨ੍ਹਾਂ ਦਾ ਸਹਾਰਾ ਲੈਂਦੀ ਹਾਂ ਅਤੇ ਆਪਣੇ ਮੇਰਾ ਜੀਵਨ ਬਹੁਤ ਖੁਸ਼ ਹੈ ਬਹੁਤ ਖੁਸ਼ਹਾਲ ਹਾਂ ਮੈਂ ਮੈਨੂੰ ਸਾ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਵੀ ਲੋੜ ਪੈਂਦੀ ਹੈ ਮੈਂ ਉਹ ਲੈਂਦੀ ਹਾਂ